ਹੈਲੋ ਕਿਵੇਂ ਹੋ ਮੈਮ ਹੋਵ ਆ ਯੂ ਅੱਜ ਅਸੀਂ ਬਹੁਤ ਸਾਰਾ ਗਰੁੱਪ ਮਤਲਬ ਸਾਡਾ ਗਰੁੱਪ ਅਸੀਂ ਮੂਵੀ ਦੇਖਣ ਆਏ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕੋਈ ਵਧੀਆ ਅੱਛੀ ਮੂਵੀ ਅਸੀਂ ਦੇਖੀਏ ਜਿਹੜੀ ਤੁਹਾਡੇ ਥੀਏਟਰ ਵਿੱਚ ਚੱਲ ਰਹੀ ਤਿਨ ਚਾਰ ਮੂਵੀਜ਼ ਇਸ ਟਾਈਮ ਚੱਲਦੀ ਪਈ ਆ ਬਟ ਇਹਨਾਂ ਵਿੱਚੋਂ ਜਿਹੜੀ ਬੈਸਟ ਜਿਹੜੀ ਬਹੁਤ ਅੱਛੀ ਮੂਵੀ ਆ ਅਸੀਂ ਉਹ ਦੇਖਣਾ ਚਾਹੁੰਦੇ ਆ ਕਿਉਂਕਿ ਅਸੀਂ ਪੰਦਰ੍ਹਾਂ ਤੋਂ ਵੀਹ ਮੈਂਬਰ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਅੱਛਾ ਡਿਸਕਾਊਂਟ ਮਿਲੇ ਔਰ ਅੱਛੀ ਸੀਟਸ ਅਵੇਲੇਬਲ ਮਿਲਣ ਜਿੱਥੇ ਅਸੀਂ ਬੈਠ ਕੇ ਖੂਬ ਇੰਜੋਏ ਕਰ ਸਕੀਏ ਔਰ ਅੱਛੀ ਮੂਵੀ ਦੇਖ ਸਕੀਏ ਔਰ ਮੂਵੀ ਨੂੰ ਬਹੁਤ ਇੰਜੋਏ ਕਰ ਸਕੀਏ ਇਹ ਮਤਲਬ ਤੁਹਾਡੇ ਇਹਦੇ ਵਿੱਚ ਕੁਝ ਮਤਲਬ ਜਿਹੜਾ ਕੋਈ ਤੁਸੀਂ ਰਿਫਰੈਸ਼ਮੈਂਟ ਦੇ ਵਿੱਚ ਕੋਈ ਕੋਂਬੋ ਮਿਲ ਜਾਵੇ ਸਾਨੂੰ ਜਾਂ ਮਤਲਬ ਜਿਹੜੇ ਉਸ ਤੋਂ ਬਾਅਦ ਆਫਟਰ ਮੂਵੀ ਅਸੀਂ ਕੋਈ ਵੀ ਪਾਰਟੀ ਕਰਨੀ ਆ ਉਹਦੇ ਵਿੱਚ ਸਾਨੂੰ ਕੋਈ ਕੋਂਬੋ ਮਿਲ ਜਾਵੇ ਜਿਹਦੇ ਨਾਲ ਸਾਡਾ ਇੰਟਰਟੇਨਮੈਂਟ ਵੀ ਅੱਛਾ ਹੋਵੇ ਮਤਲਬ ਬਹੁਤ ਘੱਟ ਪੈਸੇ ਦੇ ਵਿੱਚ ਅਸੀਂ ਬਹੁਤ ਅੱਛਾ ਇੰਜੋਏ ਕਰ ਸਕੀਏ ਕਿਉਂਕਿ ਸਾਡਾ ਗਰੁੱਪ ਬਹੁਤ ਵੱਡਾ ਆ ਅਸੀਂ ਪੰਦਰ੍ਹਾਂ ਤੋਂ ਵੀਹ ਮੈਂਬਰਸ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਾਨੂੰ ਇਹ ਫੀਲ ਨਾ ਹੋਵੇ ਕਿ ਸਾਡਾ ਬਹੁਤ ਜ਼ਿਆਦਾ ਐਕਸਪੈਂਸ ਹੋ ਗਿਆ ਹੈ ਕਿ ਮਤਲਬ ਬਹੁਤ ਘੱਟ ਖਰਚੇ ਦੇ ਵਿੱਚ ਅਸੀਂ ਬਹੁਤ ਅੱਛਾ ਲਾਭ ਲੈਣਾ ਚਾਹੁੰਦੇ ਔਰ ਬਹੁਤ ਅੱਛੇ ਮੂਵੀ ਨੂੰ ਦੇਖਣਾ ਚਾਹੁੰਦੇ ਹਾਂ ਅਤੇ ਤੁਸੀਂ ਸਾਨੂੰ ਸੁਜੈਸਟ ਕਰੋ